ਰਵਾਇਤੀ ਪਕਵਾਨ ਉਹ ਪਕਵਾਨ ਹੁੰਦੇ ਹਨ ਜੋ ਉਸ ਇਲਾਕੇ ਜਾਂ ਉਸ ਸਥਾਨ ਦੇ ਲੋਕਾਂ ਅਤੇ ਸੱਭਿਆਚਾਰ ਵੱਲ ਸਾਨੂੰ ਸੱਭਿਆਚਾਰ ਬਾਰੇ ਦੱਸਣ ਜਿਵੇਂ ਰੋਪੜ ਦੇ ਵਿੱਚ ਰਵਾਇਤੀ ਪਕਵਾਨ ਸਾਡੇ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਲੱਸੀ ਅਤੇ ਹੱਥ ਦਾ ਕੱਢਿਆ ਮੱਖਣ ਔਰ ਉਹਦੇ ਨਾਲ ਨਾਲ ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਸਾਡੇ ਉਰੇ ਗੁਲਗੁਲੇ ਕਚੌਰੀਆਂ ਔਰ ਖੀਰ ਪੂੜੇ ਆਦਿ ਤਾਂ ਹੁਣ ਜੇ ਸ ਦੇਖਿਆ ਜਾਵੇ ਤਾਂ ਸਾਡੇ ਜ਼ਿਲ੍ਹੇ ਦੇ ਵਿੱਚ ਸੱਭਿਆਚਾਰ ਦੇ ਅਤੇ ਇਤਿਹਾਸ ਦੇ ਨਾਲ ਜੁੜਿਆ ਵਾ ਸਾਡੇ ਚੱਲਦਾ ਹੈ ਗੁਲਗੁਲੇ ਕਚੌਰੀਆਂ ਔਰ ਦਿਵਾਲੀ ਦੇ ਟਾਈਮ ਪਰ ਦਿਵਾਲੀ ਦੇ ਟਾਈਮ ਪਰ ਗੁਲਗੁਲੇ ਕਚੌਰੀਆਂ ਅਤੇ ਸਾਉਣ ਦੇ ਮਹੀਨੇ ਵਿੱਚ ਸਾਡੇ ਉਰੇ ਚੱਲਦਾ ਖੀਰ ਅਤੇ ਪੂੜੇ ਔਰ ਸਾਡੇ ਸਿੱਖ ਇਤਿਹਾਸ ਦੇ ਨਾਲ ਦੇਖਿਆ ਜਾਵੇ ਤਾਂ ਉਰੇ ਮਿੱਸੀਆਂ ਰੋਟੀਆਂ ਉਹਦਾ ਲੰਗਰ ਲਾਇਆ ਜਾਂਦਾ ਮਿੱਸੀਆਂ ਰੋਟੀਆਂ ਅਸਲ ਦਰਅਸਲ ਅਸਲ ਵਿੱਚ ਹੁੰਦੀ ਹੈ ਕਿ ਆਟੇ ਦੇ ਵਿੱਚ ਬੇਹੀ ਦਾਲ ਜਾਂ ਫਿਰ ਹੋਰ ਪਿਆਜ ਅਤੇ ਕੁਛ ਹੋਰ ਬੇਹੀਆਂ ਸਬਜ਼ੀਆਂ ਨੂੰ ਮਿਲਾ ਕੇ ਉਨ੍ਹਾਂਂ ਨੂੰ ਤਵੇ 'ਤੇ ਭੁੰਨ ਕੇ ਬਣਾਇਆ ਜਾਂਦਾ ਔਰ ਰੋਪੜ ਦੇ ਵਿੱਚ ਚੰਗਾ ਖਾਣ ਦੇ ਲਈ ਅਸੀਂ ਜੇ ਜਾਣਾ ਹੋਵੇ ਤਾਂ ਰੋਪੜ ਦੇ ਵਿੱਚ ਸਾਨੂੰ ਹਵੇਲੀ ਹੈਗੀ ਸਾਡੇ ਕੋਲ ਵਧੀਆ ਖਾਣ ਦੇ ਲਈ ਉਰੇ ਬਾਈਪਾਸ 'ਤੇ ਕਈ ਸਾਰੇ ਢਾਬੇ ਹਨ ਅਤੇ ਕਾਲਜ ਰੋਡ 'ਤੇ ਸਾਡੇ ਕੋਲ ਕਈ ਸਾਰੇ ਢਾਬੇ ਹਨ ਅਤੇ ਛੋਟੀਆਂ ਛੋਟੀਆਂ ਦੁਕਾਨਾਂ 'ਤੇ ਸ਼ਾਮ ਨੂੰ ਖਾਸ ਕਰਕੇ ਬੇਲਾ ਚੌਂਕ ਦੇ ਕਰੀਬ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸਟਾਲਾਂ ਲੱਗਦੀਆਂ ਜਿੱਥੇ ਸਾਨੂੰ ਸਾਡੇ ਰਿਵਾਇਤੀ ਖਾਣੇ ਜਿਵੇਂ ਜਲੇਬੀਆਂ ਹੋਰ ਕਹਿ ਲਓ ਕਿ ਗੁਲਗੁਲੇ ਕਚੌਰੀਆਂ ਅਤੇ ਹੋਰ ਵੱਖ ਵੱਖ ਪ੍ਰਕਾਰ ਦੇ ਖਾਣੇ ਸਾਨੂੰ ਦੇਖਣ ਨੂੰ ਮਿਲਦੇ